ਚੌਦ੍ਹਾਂ ਜਨਵਰੀ ਦੋ ਹਜ਼ਾਰ ਚੌਦ੍ਹਾਂ ਸਤਾਰ੍ਹਾਂ ਫਰਵਰੀ ਦੋ ਉੱਨੀ ਸੌ ਛਿਆਨਵੇਂ

ਅਪ੍ਰੈਲ ਉੱਨੀ ਸੌ ਅਠਾਨਵੇਂ ਦਸ ਜਨਵਰੀ ਉੱਨੀ ਸੌ ਅਠਵੰਜਾ ਚੌਦ੍ਹਾਂ ਜਨਵਰੀ ਉੱਨੀ ਸੌ ਛਿਆਲ਼ੀ